ਸਟਿਮ ਦਾ ਅਰਥ ਹੈ ਵਿਗਿਆਨ ਟੈਕਨੋਲੋਜੀ ਇੰਜਨੇਰਿੰਗ ਅਤੇ ਗਣਿਤ ਅਤੇ ਇਹ ਵਿਸ਼ਿਆਂ 'ਤੇ ਅਤੇ ਇਹ ਵਿਸ਼ਿਆਂ 'ਤੇ ਫੋਟੋਆਂ ਦੀ ਇੱਕ ਵਿਸ਼ਾਲ ਸ਼੍ਰੇਣੀ ਨੂੰ ਕਵਰ ਕਰਦਾ ਹੈ ਜਿਹਨਾਂ ਦੀ ਗਲੋਬਲ ਮਾਰਕੀਟ ਵਿੱਚ ਉੱਚ ਮੰਗ ਹੈ ਸਟਿਮ ਕੋਰਸ ਵਿਦਿਆਰਥੀਆਂ ਨੂੰ ਆਲੋਚਨਾਤਮਕ ਸੋਚ ਸਮੱਸਿਆ ਹੱਲ ਕਰਨ ਰਚਨਾਤਮਕਤਾ ਅਤੇ ਨਵੀਨਤਾ ਦੇ ਹੁਨਰ ਵਿਕਸਿਤ ਕਰਨ ਵਿੱਚ ਮਦਦ ਕਰ ਸਕਦੇ ਹਨ ਭਾਰਤ ਵਿੱਚ ਬਹੁਤ ਸਾਰੀਆਂ ਯੂਨੀਵਰਸਿਟੀਆਂ ਹਨ ਜੋ ਵੱਖ ਵੱਖ ਖੇਤਰਾਂ ਵਿੱਚ ਸਟਿਮ ਕੋਰਸ ਪੇਸ਼ ਕਰਦੀਆਂ ਜਿਵੇਂ ਕਿ ਡਾਟਾ ਸਾਇੰਸ ਬੈਡ ਟੈਕਨੋਲੋਜੀ ਰੋਬੋਟਿਕਸ ਨੈਰੋ ਟੈਕਨੋਲੋਜੀ ਏਰੋ ਸਪੇਸ ਇੰਜੀਨੀਅਰਿੰਗ ਆਦਿ ਭਾਰਤ ਵਿੱਚ ਸਟਿਮ ਵਿਦਿਆਰਥੀਆਂ ਲਈ ਕੁਝ ਵਧੀਆ ਯੂਨੀਵਰਸਿਟੀਆਂ ਹਨ ਆਈ ਆਈ ਟੀ ਖੜਗਪੁਰ ਇਹ ਭਾਰਤ ਦੇ ਸਭ ਤੋਂ ਪੁਰਾਣੇ ਅਤੇ ਸਭ ਤੋਂ ਵਿਕਾਰੀ ਇੰਜੀਨੀਅਰਿੰਗ ਸਥਾਨਾਂ ਵਿੱਚੋਂ ਇੱਕ ਹੈ ਇਹ ਇੰਜੀਨੀਅਰਿੰਗ ਵਿਗਿਆਨ ਪ੍ਰਬੰਧਨ ਅਤੇ ਕਾਨੂੰਨ ਦੀਆਂ ਵੱਖ ਵੱਖ ਸ਼ਖਾਵਾਂ ਅਤੇ ਅੰਡਰ ਗ੍ਰੈਜੂਏਟ ਪੋਸਟ ਗ੍ਰੈਜੂਏਟ ਅਤੇ ਡਾਕਟਰਾਂ ਨੂੰ ਪ੍ਰੋਗਰਾਮਾਂ ਦੀ ਪੇਸ਼ਕਸ਼ ਕਰਦਾ ਹੈ ਇਸ ਵਿੱਚ ਇੱਕ ਮਜ਼ਬੂਤ ਖੋਜ ਸੱਭਿਆਚਾਰ ਵੀ ਹੈ ਅਤੇ ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸੰਸਥਾਵਾਂ ਨਾਲ ਸਹਿਯੋਗ ਹੈ ਆਈ ਆਈ ਟੀ ਦਿੱਲੀ ਇਹ ਭਾਰਤ ਵਿੱਚ ਇੱਕ ਹੋਰ ਪ੍ਰਮੁੱਖ ਇੰਜੀਨੀਅਰਿੰਗ ਸਥਾਨ ਹੈ ਜੋ ਇੰਜੀਨੀਅਰਿੰਗ ਵਿਗਿਆਨ ਟੈਕਨੋਲੋਜੀ ਦੀਆਂ ਵੱਖ ਵੱਖ ਸ਼ਖਾਵਾਂ ਵਿੱਚ ਅੰਡਰ ਗ੍ਰੈਜੂਏਟ ਪੋਸਟ ਗਰੈਜੂਏਟ ਅਤੇ ਡਾਕਟਰ ਪ੍ਰੋਗਰਾਮਾਂ ਦੀ ਪੇਸ਼ ਕਰਦਾ ਹੈ ਆਈ ਸੀ ਆਰ ਭਾਰਤੀ ਫੌਜ ਵਿੱਚ ਇਸ ਸਥਾਨ ਨੇ ਨਵੀਂ ਦਿੱਲੀ ਇਹ ਭਾਰਤੀ ਖੋਜ ਖੇਤੀ ਖੋਜ ਪਰਿਸ਼ਦ ਦਾ ਪ੍ਰਮੁੱਖ ਸਥਾਨ ਹੈ ਜੋ ਖੇਤੀਬਾੜੀ ਦੇ ਵੱਖ ਵੱਖ ਪਹਿਲੂਆਂ ਜਿਵੇਂ ਕਿ ਫਸਲ ਸੁਧਾਰ ਭੂਮੀ ਵਿਗਿਆਨ ਬੋਧ ਸੁਰੱਖਿਆ ਆਦਿ ਵਿੱਚ ਸਿੱਖਿਅਤ ਸੰਚਾਲਨ ਕਰਦਾ ਹੈ ਇਸ ਖੇਤੀਬਾੜੀ ਵਿਗਿਆਨ ਗ੍ਰੈਜੁਏਟ ਅੰਡਰ ਗ੍ਰੈਜੁਏਟ ਪੋਸ ਗ੍ਰੈਜੁਏਟ ਪ੍ਰੋਗਰਾਮ ਪੇਸ਼ ਕਰਦਾ ਹੈ ਆਈ ਆਈ ਐਮ ਬੈਗਲੁਰੁ ਇਹ ਭਾਰਤ ਅਤੇ ਦੁਨੀਆਂ ਦੇ ਚੋਟੀ ਦੇ ਪ੍ਰੋਸ ਪ੍ਰਬੰਧਨ ਸਥਾਨਾਂ ਵਿੱਚੋਂ ਇੱਕ ਹੈ ਇਹ ਪ੍ਰਬੰਧਨ ਦੇ ਵੱਖ ਵੱਖ ਖੇਤਰਾਂ ਜਿਵੇਂ ਕਿ ਵਿੱਤ ਵਿੱਤ ਮਾਰਕੀਟਿੰਗ ਸੰਚਾਰਨਾ ਰਣਨੀਤੀ ਉਦਮਤਾ ਆਦਿ ਵਿੱਚ ਪੋਸਟ ਗ੍ਰੈਜੂਏਟ ਅਤੇ ਡਾਕਟਰ ਪ੍ਰੋਗਰਾਮਾਂ ਦੀ ਪੇਸ਼ ਕਰਦਾ ਹੈ